ਅਤੇ ਜਿਵੇਂ ਕਿ ਕੀਤਾ ਜਾਂਦਾ ਦੁੱਧ ਦੀ ਫੈਟ ਵਧਾਉਣ ਨੂੰ ਆਮ ਕਈ ਅਤੇ ਉਹਨਾਂ ਨੂੰ ਜਿਵੇਂ ਕਿ ਕਿ ਕੀਤੀ ਜਾਂਦੀ ਹੈ ਦੁੱਧ ਦੀ ਫੈਟ ਨੂੰ ਵਧਾਉਣ ਨੂੰ ਵੀ ਕਈ ਤਰ੍ਹਾਂ ਦੇ ਤਰੀਕੇ ਅਲੱਗ ਅਲੱਗ ਤਰੀਕੇ ਹੁੰਦੇ ਆ ਅਲੱਗ ਅਲੱਗ ਖੁਰਾਕਾਂ ਖਵਾਈਆਂ ਜਾਂਦੀਆਂ ਨੇ ਮੱਝਾ ਗਾਵਾਂ ਨੂੰ ਪੋਸ਼ਟਿਕ ਖੁਰਾਕ ਵੀ ਉਹਨਾਂ ਨੂੰ ਉਰਜ਼ਾ ਦੇ ਤੱਤ ਹੋਣ ਵਧਾਉਣ ਦੀ ਪੈਂਦੀ ਹੈ ਜਿਵੇਂ ਕਿ ਉਹ ਮੱਝਾ ਗਾਵਾਂ ਨੂੰ ਜਿਵੇਂ ਕਿਤੇ ਕਿਤੇ ਨਾਰੀਅਲ ਦਾ ਤੇਲ ਆਦਿ ਉਹਨਾਂ ਵਿੱਚ ਚਰਬੀਆਂ ਵਧਾਉਂਦੀਆਂ ਨੇ ਅਤੇ ਇਹਨਾਂ ਨੂੰ ਮਾਤਰਾ ਵਿੱਚ ਵੱਧ ਪਾਏ ਜਾਂਦੇ ਹਨ ਪਾਚਣਹਾਰ ਜਿਵੇਂ ਮੱਝੀ ਅ ਪਸ਼ੂਆਂ ਨੂੰ ਅ ਵਧੀਆ ਪਾਣੀ ਸਾਫ਼ ਸੁਥਰਾ ਪਾਣੀ ਫਸਾਫ ਘਾ ਹਰਾ ਖਰਾ ਖਾਲਕ ਖੁਰਾਕ ਆਦਿ ਪਾਈ ਜਾਂਦੀ ਆ ਮੱਝਾਂ ਨੂੰ ਵਧੀਆ ਵੀ ਦੁੱਧ ਦੇਣ ਅਤੇ ਇਹਨਾਂ ਦੀ ਫੈਟ ਵਧੇ ਅਤੇ ਇਹਨਾਂ ਦਾ ਖਾਣਾ ਪੀਣਾ ਵਧੀਆ ਚਰੀ ਜਿਵੇਂ ਚਰੀ ਦੇ ਹੁੰਦੇ ਆ ਚਰੀ ਦੇ ਵਿੱਚ ਉਹਨਾਂ ਨੂੰ ਮੱਕੀ ਵ ਆਦਿ ਵਰਸੀਮ ਵਗੈਰਾ ਵਧੀਆ ਵੀ ਖਵਾਏ ਜਾਂਦੀਆਂ ਨੇ ਉਹਨਾਂ ਨੂੰ ਮੱਝਾਂ ਨੂੰ ਉਹਨਾਂ ਨੇ ਸੋਇਆ ਦੀ ਫਲੀ ਮੂੰਗਫਲੀ ਕਪਾਹ ਪਾਈਆਂ ਜਾਂਦੀਆਂ ਹਨ ਅਤੇ ਜਿਵੇਂ ਕਿ ਨਾਰੀਅਲ ਅਤੇ ਊਰਜਾ ਦੀ ਵਧੀਆ ਫੈਟ ਵਧਾਉਣ ਨੂੰ ਕਰਦੇ ਹਨ ਦੇਸੀ ਨੁਕਤਿਆਂ ਦੇ ਵਿੱਚ ਜਿਵੇਂ ਕਿ ਹੋ ਗਿਆ ਉਹਨਾਂ ਨੂੰ ਗਾਵਾਂ ਨੂੰ ਤਾਜ਼ਾ ਚਾਰਾ ਅਤੇ ਜਿਵੇਂ ਕਪਾਹ ਮਕਈ ਦਾ ਚਾਰਾ ਦੁੱਧ ਨੂੰ ਵਧਾਉਂਦੀਆਂ ਨੇ ਫੈਟ ਅਤੇ ਉਹਨਾਂ ਨੂੰ ਖਾਣ ਪੀਣ ਦੀ ਐਜਵੈਨ ਦੀ ਪਾਚਨ ਸ਼ਕਤੀ ਅਜਵਾਇਣ ਪਾਈ ਜਾਂਦੀ ਆ ਉਹਨਾਂ ਚਾਰੇ ਦੇ ਵਿੱਚ ਮਿਲਾ ਕੇ ਖਵਾਇਆ ਜਾਂਦਾ ਵਾ ਗਾਵਾਂ ਨੂੂੰ ਜਿਵੇਂ ਕਿ ਵਧੀਆ ਸਾਫ਼ ਸੁਥਰਾ ਪਾਣੀ ਪਿਲਾ ਕੇ ਵੀ ਪਾਚਨ ਸੀਖਿਆ ਵੀ ਵੱਧਦੀ ਹੈ ਅਤੇ ਜਿਵੇਂ ਕਿ ਸਾਰੀ ਖਾੜ ਆਦਿ ਖਲ ਪੈ ਜਾਂਦੀ ਹੈ ਖਲ ਦੇ ਵਿੱਚ ਮਿਲਾ ਕੇ ਆਦਿ ਮਿਲਾ ਕੇ ਦੁੱਧ ਦੀ ਫੈਟ ਵਧਾਉਂਦੇ ਹਨ ਉਹਨਾਂ ਨੂੰ ਗੁੜ ਅਤੇ ਲਸਣ ਦੀ ਤਸੀਰ ਦਿੱਤੀ ਜਾਂਦੀ ਹੈ ਗਾਵਾਂ ਨੂੰ ਮਿਠਾਸ ਲਈ ਵਧਾਉਂਦੀ ਹੈ ਜੋ ਫੈਟ ਦੀ ਮਦਦ ਕਰ ਕਰਦੀ ਹੈ